ਸਤਿ ਸ਼੍ਰੀ ਕਾਲ ਜੀ ਧਰਮ ਦੇ ਮੇਰੇ ਖੇਤਰ ਵਿੱਚ ਸੈਰ ਸਪਾਟੇ ਨੂੰ ਕੁਝ ਇਸ ਤਰ੍ਹਾਂ ਪ੍ਰਭਾਵਿਤ ਕਰਦੇ ਹਾਂ ਜੇਕਰ ਵਿਅਕਤੀ ਧਾਰਮਿਕ ਹੋਵੇਗਾ ਤਾਂ ਉਸਨੂੰ ਇੱਕ ਸਿਧਾਂਤ ਦਿੱਤਾ ਜਾਂਦਾ ਹੈ ਕਿ ਬ੍ਰਹਮ ਮੂੜ ਜੋਤ ਜੋਤਣਾ ਬ੍ਰਹਮ ਰਜੋਟ ਕਿ ਪੂਰੇ ਤਰੀਕੇ ਨਾਲ ਆਪਣਾ ਵੋ ਹੈ ਘਰ ਦਾ ਐਕਸਰਸਾਈਜ਼ ਕਰਨੀ ਸਰੀਰ ਨੂੰ ਰੱਖਣਾ ਫਿਰ ਸੈਰ ਸਪਾਟੇ 'ਤੇ ਨਿਕਲਣਾ ਪੂਰੇ ਤਰੀਕੇ ਨਾਲ ਐਕਸਰਸਾਈਜ ਕਰਨੀ ਯੋਗਾ ਮੈਡੀਟੇਸ਼ਨ ਕਰਨੀ ਗ੍ਰੰਥਾਂ ਦਿਨ ਗੰਨਾ ਵਿੱਚ ਇਸੇ ਪ੍ਰਕਾਰ ਨਾਲ ਸੈਰ ਸਪਾਟਾ ਮੇਰੇ ਖੇਤਰ ਵਿੱਚ ਪ੍ਰਭਾਵਿਤ ਕੀਤਾ ਹੈ ਇਸ ਪ੍ਰਕਾਰ ਨਾਲ ਧਰਮ ਮੇਰੇ ਖੇਤਰ ਵਿੱਚ ਸੈਰ ਸਪਾਟੇ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਮੈਂ ਅੰਮ੍ਰਿਤਸਰ ਖੇਤਰ ਵਿੱਚ ਰਹਿਣ ਵਾਲਾ ਹਾਂ ਅਤੇ ਇਸ ਜਗ੍ਹਾ 'ਤੇ ਇੱਕ ਅਜਿਹੀ ਥਾਂ ਹੈ ਜਿੱਥੇ ਹਰ ਭਾਰਤੀ ਜਾਂਦਾ ਹੈ ਅਤੇ ਦੋ ਤਿੰਨ ਥਾਵਾਂ 'ਤੇ ਇੱਕ ਸਰਵਨ ਮੰਦਰ ਹੈ ਜਿਸ ਨੂੰ ਜਿਹਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ ਇੱਕ ਜਲ੍ਹਿਆਂ ਵਾਲਾ ਬਾਗ ਇੱਕ ਰਾਮ ਤੀਰਥ ਇੱਥੇ ਦੇਸ਼ ਭਰ ਵਿ ਤੋਂ ਹੀ ਵਿਦੇਸ਼ਾਂ ਗੀ ਤੋਂ ਵੀ ਲੋਕ ਆਉਂਦੇ ਨੇ ਘੁੰਮਣ ਆਪਣਾ ਵਿਹਲਾ ਸਮਾਂ ਛੁੱਟੀਆਂ ਦਾ ਸਮਾਂ ਬਿਤਾਉਣ ਆਉਂਦੇ ਨੇ ਅਤੇ ਭਗਵਾਨ ਦੀ ਭਗਵ ਭਗਤੀ ਕਰਨ ਪਾਕਿਸਤਾਨ ਇੰਡੀਆ ਦਾ ਬਾਰਡਰ ਦੇਖਣ ਪਰੇਡ ਦੇਖਣ ਅਤੇ ਵਿਸ਼ੇਸ਼ ਤੌਰ 'ਤੇ ਲੰਗਰ ਚੱਲਦਾ ਹੈ ਅਤੇ ਹੋਰ ਵੀ ਬਹੁਤ ਖਾਸ ਖਾਸ ਯਾਦਾਂ ਨੇ ਜੋ ਇਸ ਖੇਤਰ ਨਾਲ ਜੁੜੀਆਂ ਨੇ ਜਿਵੇਂ ਕਿ ਹਰਿਮੰਦਰ ਸਾਹਿਬ ਦੀ ਗੱਲ ਕਰ ਦਿੱਤੀ ਜਾਵੇ ਤਾਂ ਇਹਦੇ ਚਾਰ ਦਰਵਾਜ਼ੇ ਨੇ ਜਿਹੜੇ ਚਾਰ ਦਿਸ਼ਾਵਾਂ ਵਿੱਚ ਨੇ ਅਤੇ ਚਾਰੋਂ ਧਰਮਾਂ ਵਾਸਤੇ ਖੁੱਲ੍ਹੇ ਨੇ ਇਸੇ ਪ੍ਰਕਾਰ ਨਾਲ ਹੋਰ ਜਿਵੇਂ ਜਲ੍ਹਿਆਂ ਵਾਲਾ ਬਾਗ ਵੀ ਹੈ ਜਿੱਥੇ ਕਾਫੀ ਲੋਕ ਆਉਂਦੇ ਨੇ ਦੇਸ਼ ਭਰ ਤੋਂ ਅਤੇ ਕਈ ਚੀਜ਼ਾਂ ਇਤਿਹਾਸਿਕ ਨਵੀਆਂ ਸਿੱਖ ਕੇ ਜਾਂਦੇ ਨੇ ਧੰਨਵਾਦ ਜੀ